ਹਾਂ ਮੈਂ ਇਹ ਕੀਤਾ ਹੈ ਇੱਕ ਵਾਰੀ ਮੈਂ ਡਰਾਇੰਗ ਬਣਾਈ ਸੀ ਉਹਦੇ 'ਚ ਮੈਂ ਉਹਦੇ 'ਚ ਮੈਂ ਪਾਣੀ ਦਰਖਤ ਪਹਾੜ ਬਣਾਏ ਸੀਗੇ ਹੈ ਨਾ ਅਤੇ ਬਰਫ ਬਣਾਈ ਸੀਗੀ ਉਹਦੇ 'ਚ ਐਵੇਂ ਸੀਗਾ ਕਿ ਅੱਜ ਕੱਲ੍ਹ ਇਹ ਮੇਰਾ ਰੀਜਨ ਤਾਂ ਸੀਗਾ ਬਣਾਉਣ ਦਾ ਕਿਉਂਕਿ ਅੱਜ ਕੱਲ੍ਹ ਜਿਹੜਾ ਪਾਣੀ ਹੈਗਾ ਉਹ ਘਟੀ ਜਾਂਦਾ ਹੈਗਾ ਉਹਦਾ ਲੈਵਲ ਜਿਹੜਾ ਘਟੀ ਜਾਂਦਾ ਹੈਗਾ ਲੋਕ ਝੋਨਾ ਲਾਈ ਜਾਂਦੇ ਆ ਉਹਨੂੰ ਹਟਦੇ ਨਹੀਂ ਹੈਗੇ ਪਾਣੀ ਗਰਾਉਂਡ ਲੈਵਲ ਜਿਹੜਾ ਹੈਗਾ ਪਾਣੀ ਦਾ ਬਹੁਤ ਘੱਟ ਹੋ ਗਿਆ ਹੈਗਾ ਬਹੁਤ ਘੱਟ ਗਿਆ ਹੈਗਾ ਜਿਹੜਾ ਜਿਵੇਂ ਫੋਰੈਸਟ ਹੈਗੇ ਹੈ ਨਾ ਫੋਰੈਸਟ ਅੱਜ ਕੱਲ੍ਹ ਲੋਕ ਕੱਟੀ ਜਾਂਦੇ ਉਹਨਾਂ ਦੇ ਦਰੱਖਤ ਬਣਾਈ ਜਾਂਦੇ ਆ ਉਹਨਾਂ ਦੀ ਥਾਂ 'ਤੇ ਸਿਟੀਸ ਬਣੀ ਜਾਂਦੀਆਂ ਵਿਲੀਜਸ ਬਣੇ ਜਾਂਦੇ ਹੈਗੇ ਆ ਬਰਫ ਜਿਹੜੀ ਹੈਗੀ ਆ ਓਜ਼ੋਨ ਲੇਅਰ ਦੇ ਕਰਕੇ ਪਿਘਲੀ ਜਾਂਦੀ ਹੈਗੀ ਹੈ ਉਹਦੇ ਅੱਜ ਇਸ ਵਾਰੀ ਤਾਂ ਉਵੇਂ ਵੀ ਬੁਰਾ ਹਾਲ ਹੈਗਾ ਇਸ ਵਾਰੀ ਮੀਂਹ ਨਹੀਂ ਪਿਆ ਹੈਗਾ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈਗੀ ਹੈ ਸਾਰੀ ਅਤੇ ਗਰਮੀ ਇਸ ਵਾਰੀ ਬਹੁਤ ਹੀ ਜ਼ਿਆਦਾ ਹੈਗੀ ਆ ਅਤੇ ਹੁਣ ਬਹੁਤ ਜ਼ਿਆਦਾ ਲੇਟ ਹੋ ਗਿਆ ਅਜੇ ਤੱਕ ਠੰਡ ਵੀ ਨਹੀਂ ਆਈ ਹੈਗੀ ਹੈਗੀ ਆ ਤਾਂ ਮੈਂ ਇਹਦੇ 'ਚ ਮੈਂ ਇਹ ਦਿਖਾਉਣਾ ਚਾਹੁੰਦਾ ਹਾਂ ਪੇੜਾਂ ਨੂੰ ਕੱਟਿਆ ਜਾਂਦਾ ਸ਼ਹਿਰ ਬਣਾਏ ਜਾਂਦੇ ਆ ਸ਼ਹਿਰ ਬਣਾਏ ਜਾਂਦੇ ਆ ਉਹਦੇ ਤੋਂ ਕੁਝ ਪੋਲੂਸ਼ਨ ਫੈਲਦਾ ਪੋਲਊਸ਼ਨ ਫੈਲਦਾ ਹੈਗਾ ਉਹਦੇ ਕਰਕੇ ਗਰਮੀ ਵੱਧਦੀ ਪਈ ਹੈ ਗਰਮੀ ਵੱਧਦੀ ਪਈ ਹੈ ਉਹਦੇ ਕਰਕੇ ਜਿਹੜੀ ਹੈਗੀ ਹੈ ਮੌਸਮ ਸਹੀ ਨਹੀਂ ਰਹਿੰਦਾ ਆਪਣਾ ਮੌਸਮ 'ਚ ਬਹੁਤ ਜ਼ਿਆਦਾ ਬਦਲਾਵ ਆਉਂਦੇ ਪਏ ਆ ਅੱਜ ਕੱਲ੍ਹ ਦੇ ਜ਼ਮਾਨੇ 'ਚ